ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਹਾਂਜੀ ਮੈਂ ਮੋਬਾਈਲ ਔਰਡਰ ਕਰਿਆ ਤਾ ਜੀ ਤੁਹਾਨੂੰ ਹਾਂਜੀ ਹਾਂਜੀ ਮੋਬਾਈਲ ਤੁਹਾਡਾ ਬਹੁਤ ਵਧੀਆ ਹੈ ਜੀ ਹਾਂਜੀ ਕੈਮਰਾ ਵੀ ਠੀਕ ਹੈ ਹਾਂਜੀ ਫੋਟੋ ਬਹੁਤ ਵਧੀਆ ਆਉਂਦੀ ਸਾਫ਼ ਸੁਥਰੀ ਆਉਂਦੀ ਉਹਦੇ 'ਚ ਜੀ ਠੀਕ ਹੈ ਜੀ ਹਾਂਜੀ ਕੰਪਨੀ ਵੀ ਬਹੁਤ ਵਧੀਆ ਜੀ ਕੰਪਨੀ ਜਿਹੜੀ ਕੰਪਨੀ ਦਾ ਫੋਨ ਆ ਉਹ ਕੰਪਨੀ ਵੀ ਬਹੁਤ ਵਧੀਆ ਹੈ ਜੀ ਹਾਂਜੀ ਠੀਕ ਹੈ ਜੀ ਜੀ ਆਵਾਜ਼ ਵੀ ਬੜੀ ਸਾਫ਼ ਹੈ ਜੀ ਠੀਕ ਹੈ ਜੀ ਧੰਨਵਾਦ ਜੀ